ਪੰਜਾਬੀ ਭਾਸ਼ਾ ਭਾਰਤ ਦੀ ਸਰਕਾਰੀ ਭਾਸ਼ਾ ਹਿੰਦੀ ਨਾਲ ਤੁਲਨਾ ਕਰਨ ਬਾਰੇ ਮੇਰੇ ਵਿਚਾਰ ਹਨ ਕਿ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਸਾਡੀ ਸਟੇਟ ਦੀ ਭਾਸ਼ਾ ਹੈ ਪੰਜਾਬੀ ਭਾਸ਼ਾ ਵਿੱਚ ਹੀ ਸਾਡੇ ਸਾਰਾ ਇਤਿਹਾਸ ਲਿਖਿਆ ਗਿਆ ਸਾਡੀਆਂ ਕਥਾ ਕਹਾਣੀਆਂ ਨਾਟਕ ਹੋਏ ਸਾਰੇ ਪੰਜਾਬੀ ਭਾਸ਼ਾ 'ਚ ਲਿਖੇ ਗਏ ਹਨ ਪੰਜਾਬੀ ਭਾਸ਼ਾ ਜਿੱਥੇ ਵੀ ਸ ਭਾਰਤ ਦੇ ਸੰਸਾਰ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਕੋਈ ਜਾ ਕੇ ਪੰਜਾਬੀ ਵੱਸਦਾ ਹੈ ਉਹ ਆਪਣੀ ਪੰਜਾਬੀ ਭਾਸ਼ਾ ਹੀ ਬੋਲਦਾ ਹੈ ਸੋ ਜੇ ਅਸੀਂ ਕਹੀਏ ਕਿ ਪੰਜਾਬੀ ਭਾਸ਼ਾ ਦੀ ਤੁਲਨਾ ਹਿੰਦੀ ਨਾਲ ਅਤੇ ਕਾਫੀ ਜਿਹੜੇ ਹਿੰਦੀ ਭਾਸ਼ਾ ਦੇ ਅੱਖਰ ਨੇ ਉਹ ਸਾਡੀ ਪੰਜਾਬੀ ਭਾਸ਼ਾ ਨਾਲ ਮਿਲਦੇ ਜੁਲਦੇ ਹਨ ਜਿਸ ਤਰ੍ਹਾਂ ਆਪਾਂ ਹਿੰਦੀ ਵਿੱਚ ਵੀ ਬਾਹਰ ਨੂੰ ਬਾਹਰ ਹੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਵੀ ਅਸੀਂ ਬਾਹਰ ਹੀ ਕਹਿੰਦੇ ਹਾਂ ਸ਼ਹਿਰ ਕਹਿੰਦੇ ਨੇ ਸ਼ਹਿਰੀ ਕਹਿੰਦੇ ਨੇ ਇਸ ਕਰਕੇ ਮੇਰੇ ਇਹ ਵਿਚਾਰ ਹਨ ਕਿ ਪੰਜਾਬੀ ਭਾਸ਼ਾ ਜਿਹੜੀ ਆ ਹਿੰਦੀ ਭਾਸ਼ਾ ਨਾਲ ਕਾਫੀ ਮੇਲ ਜੋਲ ਖਾਂਦੀ ਹੈ